ਸਮੇਂ ਸਮੇਂ ਦੇ ਨਾਲ ਪੰਜਾਬ ਦੀ ਜਨਸੰਖਿਆ ਵਿੱਚ ਬਹੁਤ ਹੀ ਵੱਡਾ ਬਦਲਾਵ ਦੇਖਣ ਨੂੰ ਮਿਲ ਰਿਹਾ ਹੈ ਜਿਹੜਾ ਕਿ ਸਭ ਤੋਂ ਜੋ ਮੇਨ ਬਦਲਾਅ ਹੈ ਮੁੱਖ ਬਦਲਾਅ ਹੈ ਉਹ ਹੈ ਸੋਸ਼ਲ ਮੀਡੀਆ ਦਾ ਸੋਸ਼ਲ ਮੀਡੀਆ 'ਤੇ ਲੋਕ ਇੰਨੇ ਕੁ ਬੀਜੀ ਹੋ ਚੁੱਕੇ ਨੇ ਕਿ ਉਹਨਾਂ ਨੂੰ ਘਰ ਦੇ ਰਿਸ਼ਤੇ ਤਾਂ ਬਹੁਤ ਦੂਰ ਦੀ ਗੱਲ ਘਰ ਦੇ ਕੰਮਾਂ ਕਾਰ ਕਰਨ 'ਚ ਵੀ ਟਾਈਮ ਨਹੀਂ ਲੱਗਦਾ ਕੋਈ ਪਹਿਲਾਂ ਹੁੰਦਾ ਸੀ ਪੰਜਾਬ ਦੇ ਵਿੱਚ ਜਿੱਦਾਂ ਕਿ ਸ਼ਾਮੀ ਰੋਟੀ ਵੇਲੇ ਸਾਰੇ ਇਕੱਠੇ ਬਹਿ ਕੇ ਰੋਟੀ ਖਾਂਦੇ ਅਤੇ ਕੋਲ ਬਹਿੰਦੇ ਦੁੱਖ ਸੁੱਖ ਸਾਂਝੇ ਕਰਦੇ ਸ਼ਾਮ ਨੂੰ ਇਕੱਠੇ ਮੰਜੇ 'ਤੇ ਪੈਂਦੇ ਇੱਕੋ ਵਿਹੜੇ ਵਿੱਚ ਮੰਜੇ ਡਾਹ ਕੇ ਸੌਂਦੇ ਹੁੰਦੇ ਸੀ ਪਰ ਜੋ ਅੱਜ ਦਾ ਜ਼ਮਾਨਾ ਹੈਗਾ ਅੱਜ ਦੀ ਆਬਾਦੀ ਹੈ ਉਹ ਹਰ ਇੱਕ ਬੰਦਾ ਆਪਦਾ ਫੋਨ ਲੈ ਕੇ ਜਾਂ ਆਪਦੇ ਕਮਰੇ 'ਚ ਵੜ ਜਾਣਾ ਹੈਗਾ ਜਾਂ ਉਹਨੇ ਫੋਨ ਲੈ ਕੇ ਬਾਹਰ ਲੰਘ ਜਾਣਾ ਹੈਗਾ ਨਾ ਉਹਨੂੰ ਕੋਈ ਘਰਦਿਆਂ ਦਾ ਹੈਗਾ ਨਾ ਆਪਣਿਆਂ ਦਾ ਹੈਗਾ ਉਹਨੇ ਬਸ ਇੱਕ ਉਹ ਇੱਕ ਅਲੱਗ ਹੀ ਦੁਨੀਆ ਦੇ ਵਿੱਚ ਹੁੰਦਾ ਹੈਗਾ ਫੋਨ ਨੂੰ ਲੈ ਕੇ ਜਿੱਦਾਂ ਜਿੱਦਾਂ ਕਿ ਉਹ ਫੋਨ 'ਤੇ ਦੇਖਦਾ ਹੈਗਾ ਉਹਦੇ ਸ਼ੌਕਾਂ ਦੇ ਤਬਦੀਲੀਆਂ ਆਉਂਦੀਆਂ ਪਹਿਲਾਂ ਕੀ ਹੁੰਦਾ ਸੀਗਾ ਵੀ ਪੰਜਾਬ ਦੇ ਲੋਕਾਂ ਨੂੰ ਖੇਡਾਂ ਵਿੱਚ ਜ਼ਿਆਦਾ ਰੁਚੀ ਹੁੰਦੀ ਸੀਗੀ ਅੱਜ ਕੱਲ ਤਾਂ ਉਹ ਗੇਮਾਂ ਲੋਕ ਗੇਮ ਹੁਣ ਵੀ ਖੇਡਦੇ ਨੇ ਪਰ ਉਹ ਗੇਮਾਂ ਔਨਲਾਈਨ ਪਲੇਟਫਾਰਮ ਚਲੀਆਂ ਗਈਆਂ ਜੋ ਕਿ ਉਹਨਾਂ ਵਾਸਤੇ ਮੋਬਾਇਲ ਇੱਕ ਜ਼ਰੀਆ ਬਣ ਗਿਆ ਮੋਬਾਈਲ ਉਹਨਾਂ ਦਾ ਗਰਾਊਂਡ ਹੈ ਅਤੇ ਹੱਥ ਉਹਨਾਂ ਦੇ ਜੋ ਨੇ ਉਹਨੂੰ ਖੇਡਣ ਵਾਸਤੇ ਬਣਨੇ ਆ ਬਸ ਲੋਕ ਪਹਿਲਾਂ ਪੰਜਾਬ ਦੇ ਲੋਕ ਖੇਡਾਂ ਕਰਦੇ ਇਕੱਠੇ ਹੈ ਨਾ ਪਰ ਉਹਦੇ ਜ ਜਿਵੇਂ ਜਿਵੇਂ ਸੋਸ਼ਲ ਮੀਡੀਆ ਦਾ ਜ਼ਮਾਨਾ ਵੱਧਦਾ ਜਾ ਰਿਹਾ ਹੈਗਾ ਹੈ ਨਾ ਉਹਦੇ ਨਾਲ ਲੋਕਾਂ ਦੇ ਸ਼ੌਕ ਵੀ ਡਿਵੈਲਪ ਹੁੰਦੇ ਜਾ ਰਹੇ ਨੇ ਜਵਾਕ ਖੇਡਾਂ ਦੀ ਬਜਾਏ ਇੱਕ ਉਹ ਜੋ ਉੱਪਰਲੀ ਦਿੱਖ ਹੁੰਦੀ ਹੈ ਪਹਿਰਾਵਾ ਹੋਵੇ ਜਿੱਦਾਂ ਕਿ ਹੈ ਨਾ ਇੱਕ ਅਮੀਰੀਪਣ ਜਿਹਾ ਹੋ ਗਿਆ ਉਸ ਨੂੰ ਲੋਕ ਆਪਣੇ ਆਪ 'ਤੇ ਅਪਣਾਉਂਦੇ ਜਾ ਰਹੇ ਨੇ ਉਹਦੇ ਲਈ ਬੰਦਾ ਜਦੋਂ ਬੰਦਾ ਅਮੀਰੀ ਹਾਸਲ ਕਰਨ ਵਾਸਤੇ ਠੀਕ ਹੈ ਬੰਦਾ ਚੰਗਾ ਕੋਈ ਸ਼ਹਿਰ ਭਾਲੇਗਾ ਜਿੱਦਾਂ ਕਿ ਪੰਜਾਬ 'ਚ ਜ਼ਿਆਦਾਤਰ ਬੰਦੇ ਹੈ ਨਾ ਜਿਹਨਾਂ ਕੋਲ ਲਾਗੇ ਸ਼ਹਿਰ ਲੱਗਦਾ ਹੈਗਾ ਉੱਥੇ ਚਲੇ ਗਏ ਉੱਥੇ ਰਹਿਣ ਲੱਗ ਗਏ ਪਰਿਵਾਰ ਨੂੰ ਨਾਲ ਲੈ ਕੇ ਕਿਉਂਕਿ ਜੋ ਸ਼ਹਿਰ ਦਾ ਮਾਹੌਲ ਹੈਗਾ ਨਾ ਉੱਥੇ ਹਰ ਚੀਜ਼ ਉਪਲਬਧ ਹੁੰਦੀ ਹੈਗੀ ਮਾਰਕੀਟ ਦੇ ਵਿੱਚ ਉਸ ਤੋਂ ਇਲਾਵਾ ਜੋ ਉੱਥੋਂ ਦਾ ਦੇਰ ਰਾਤ ਤੱਕ ਘੁੰਮਣਾ ਫਿਰਨਾ ਹੁੰਦਾ ਹੈਗਾ ਉਹ ਉਸ ਚੀਜ਼ ਨੂੰ ਬਹੁਤ ਵੱਡਾ ਪ੍ਰਭਾਵਿਤ ਕਰਦਾ ਹੈਗਾ ਜਿਹਦੇ ਨਾਲ ਪਿੰਡਾਂ ਦੇ ਪਿੰਡ ਖਾਲੀ ਹੁੰਦੇ ਜਾ ਰਹੇ ਨੇ ਅਤੇ ਸ਼ਹਿਰ ਵੱਧਦੇ ਜਾ ਰਹੇ ਨੇ ਅਤੇ ਸ਼ਹਿਰ ਵਧਣਗੇ ਤਾਂ ਉੱਥੇ ਆਬਾਦੀ ਵਧੇਗੀ ਆਬਾਦੀ ਵਧੇਗੀ ਤਾਂ ਉੱਥੇ ਸੰਘਣਤਾ ਵਧੇਗੀ ਅਤੇ ਜੇ ਉਹਦੀ ਸੰਘਣਤਾ ਵਧੀ ਤਾਂ ਹਰ ਇੱਕ ਬੰਦੇ ਦੇ ਅਲੱਗ ਅਲੱਗ ਸ਼ੌਕ ਨੇ ਜਿੱਦਾਂ ਕਿ ਸਭ ਤੋਂ ਵੱਡਾ ਸ਼ੌਕ ਜੋ ਹੈ ਏ ਸੀ ਦਾ ਹੈਗਾ ਹਰ ਇੱਕ ਬੰਦਾ ਏ ਸੀ ਲਵਾਊਗਾ ਘਰ ਆਪਦੇ ਉੱਥੇ ਜੋ ਗਲੋਬਲ ਲੈਵਲ 'ਤੇ ਦੇਖੀਏ ਆਪਾਂ ਤਾਂ ਜਿਹੜਾ ਉਸਦਾ ਟੈਮਰੇਚਰ ਆ ਇੱਕ ਸ਼ਹਿਰ ਦਾ ਅਤੇ ਇੱਕ ਪਿੰਡ ਦਾ ਉਹਦਾ ਘੱਟੋ ਘੱਟ ਚਾਰ ਤੋਂ ਪੰਜ ਡਿਗਰੀ ਦਾ ਫਰਕ ਹੁੰਦਾ ਹੈਗਾ ਸਿਰਫ ਇਸ ਕਰਕੇ ਕਿਉਂਕਿ ਸ਼ਹਿਰ 'ਚ ਜਾ ਕੇ ਬੰਦੇ ਦੇ ਸ਼ੌਕ ਬਦਲ ਜਾਂਦੇ ਨੇ ਬੰਦਾ ਗੱਡੀਆਂ 'ਤੇ ਆ ਜਾਂਦਾ ਏ ਸੀ ਲਵਾ ਲੈਂਦਾ ਹੈਗਾ ਜੋ ਪਿੰਡਾਂ 'ਚ ਹੁੰਦਾ ਹੈਗਾ ਪਿੰਡਾਂ 'ਚ ਕੀ ਹੁੰਦਾ ਬੰਦਾ ਨੋਰਮਲ ਪੱਖੇ ਲੱਗੇ ਹੁੰਦੇ ਨੇ ਆਸੇ ਪਾਸੇ ਖੇਤ ਹੁੰਦਾ ਹੈ ਪਾਣੀ ਲੱਗਦਾ ਹੈਗਾ ਉਹਦੇ ਕਰਕੇ ਠੰਡੀ ਹਵਾ ਆਉਂਦੀ ਹੈਗੀ ਹੈ ਇਸ ਕਰਕੇ ਸ਼ਹਿਰੀ ਆਬਾਦੀ ਵੱਧਦੀ ਜਾ ਰਹੀ ਆ ਅਤੇ ਪੇਂਡੂ ਆਬਾਦੀ ਘੱਟਦੀ ਜਾ ਰਹੀ ਆ